ਸਾਡੇ ਖੇਤਰ ਵਿੱਚ ਸੈਲਾਨੀਆਂ ਨਾਲ ਮੇਰਾ ਬਹੁਤ ਚੰਗਾ ਵਰਤਾਅ ਰਿਹਾ ਹੈ ਉਹ ਇਸ ਕਰਕੇ ਕਿ ਮੈਂ ਇੱਕ ਸਰਦਾਰ ਹਾਂ ਅਤੇ ਪੱਗ ਬੰਨ੍ਹਦਾ ਹਾਂ ਉਹ ਹਮੇਸ਼ਾ ਹੀ ਮੈਨੂੰ ਆ ਕੇ ਸਰਦਾਰ ਜੀ ਕਹਿੰਦੇ ਹਨ